ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਅਸੀਂ ਅੰਮ੍ਰਿਤਸਰ ਤੋਂ ਬੋਲ਼ਦੇ ਹਾਂ ਅਸੀਂ ਮੋਹਾਲੀ ਜਿਹੜੇ ਤੁਸੀਂ ਟੂਰਿਸਟ ਵਾਲੇ ਇਨ੍ਹਾਂ ਨਾਲ ਗੱਲ ਕਰਨੀ ਹੈ ਪਾਲ ਢਾਬੇ ਵਾਲੇ ਨਾਲ ਹਾਂਜੀ ਹਾਂਜੀ ਮੈਮ ਅਸੀਂ ਨਾ ਮਤਲਬ ਤੁਹਾਤੋਂ ਇਥੇ ਮਤਲਵ ਕੀ ਮੋਹਾਲੀ ਘੁੰਮਣ ਲਈ ਆਉਂਣਾ ਅਸੀਂ ਇਥੇ ਬੁਕਿੰਗ ਵਗੈਰਾ ਕਰਨੀ ਹੈ ਕਮਰੇ ਦੀ ਹਾਂਜੀ ਪੂਰਾ ਮਤਲਬ ਕੀ ਸਾਨੂੰ ਪੂਰਾ ਉਹ ਮਿਲੂਗਾ ਇਥੇ ਵੀ ਜੋ ਰੂਮ ਸਾਫ ਸੁਫ ਹੋਵੇ ਅਤੇ ਖਾਣ ਪੀਣ ਦਾ ਇਧਰ ਠੀਕ ਹੈ ਅਤੇ ਸਾਨੂੰ ਮਤਲਬ ਕੀ ਜਿਵੇਂ ਅਸੀਂ ਮੋਹਾ ਮੋਹਾਲੀ 'ਚ ਘੁੰਮਣਾ ਹੈ ਅਤੇ ਇਹਦੇ ਵਾਸਤੇ ਤੁਹਾਡੀ ਟਰੈਵਲ ਦਾ ਹੈਗਾ ਹੈ ਇੰਤਜ਼ਾਮ ਮਤਲਬ ਕੀ ਗੱਡੀ ਵਗੈਰਾ ਠੀਕ ਹੈ ਜੀ ਮਤਲਬ ਕੀ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਤਾਂ ਨਹੀਂ ਆਊਗੀ ਕਿਉਂਕਿ ਸਾਡੀ ਫੈਮਿਲੀ ਹੈ ਨਾ ਨਾਲ ਠੀਕ ਹੈ ਜੀ ਮਤਲਵ ਕੀ ਰਹਿਮਤ ਕੀ ਜਿਸ ਤਰ੍ਹਾਂ ਵੀ ਅਸੀਂ ਚਾਰ ਕੁ ਦਿਨ ਲਾਉਂਣੇ ਹੈ ਇਧਰ ਘੁੰਮਣ ਵਾਸਤੇ ਤਾਂ ਉਹਦੀ ਪੂਰੀ ਸਬਸਿਟੀ ਹੈਗੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਮਤ ਠੀਕ ਹੈ ਜੀ ਅਤੇੇ ਮੈਮ ਅਸੀਂ ਬੁਕਿੰਗ ਔਨਲਾਈਨ ਕਰ ਦਈਏ ਕਿ ਮਤਲਬ ਕੀ ਇਧਰ ਹੀ ਆ ਕੇ ਕਰੀਏ ਤੁਹਾਡੇ ਕੋਲ ਹੀ ਠੀਕ ਹੈ ਹਾਂਜੀ ਠੀਕ ਹੈ ਮੈਮ ਔਨਲਾਈਨ ਬੁਕਿੰਗ ਕਿੰਨੀ ਹੈ ਠੀਕ ਹੈ ਮੈਮ ਅਸੀਂ ਮਤਲਬ ਕੀ ਚਾਰ ਮੈਂਬਰ ਹੈਗੇਂ ਅਤੇ ਸਾਡਾ ਹਾਂਜੀ ਫਿਰ ਦੋ ਰੂਮ ਤਾਂ ਸਾਨੂੰ ਚਾਹੀਦੇ ਹੀ ਹੈਗੇਂ ਅਤੇ ਸਾਨੂੰ ਦੱਸ ਦੋ ਕਿਵੇਂ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਜੀ ਓਕੇ ਜੀ ਓਕੇ ਓਕੇ ਓਕੇ